ਮੈਂ ਕੇਂਦਰ ਵਿਦਿਆਲੇ ਦਾ ਸ਼ਾਤਰ ਰਿਹਾ ਹਾਂ ਕੇਂਦਰ ਵਿਦਿਆਲੇ ਕਿਉਂਕਿ ਇੱਕ ਸੈਂਟਰ ਸਕੂਲ ਹੈ ਜਿਹਦੀ ਬ੍ਰਾਂਚਾਂ ਸਾਰੇ ਦੇਸ਼ ਵਿੱਚ ਫੈਲੀਆਂ ਹੋਈਆ ਨੇ ਇਸ ਕਰਕੇ ਕਿਸੇ ਧਰਮ ਵਿਸ਼ੇਸ਼ ਬਾਰੇ ਅਧਿਐਨ ਨਹੀਂ ਕਰਵਾਇਆ ਜਾਂਦਾ ਪਰ ਸਾਡੇ ਪਾਠਕ੍ਰਮ ਵਿੱਚ ਸਾਨੂੰ ਵੱਖ ਵੱਖ ਧਰਮਾਂ ਬਾਰੇ ਉਹਦੀ ਜਿਹੜੀ ਮੂਲ ਜਾਣਕਾਰੀ ਹੈ ਉਹ ਦਿੱਤੀ ਜਾਂਦੀ ਹੈ ਇਹ ਪੜ੍ਹਾਈ ਕਰਕੇ ਮੈਨੂੰ ਜਿਹੜੀ ਗੱਲ ਸਮਝ ਆਈ ਹੈ ਕਿ ਸਾਰੇ ਧਰਮ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਸੱਚ ਬੋਲਣਾ ਇੱਦਾਂ ਦੀ ਚੀਜ਼ਾਂ ਸਾਨੂੰ ਸਿਖਾਉਂਦੇ ਨੇ ਅਤੇ ਉਹਦਾ ਆਪਾਂ ਆਪਣੇ ਜੀਵਨ ਵਿੱਚ ਪਾਲਣ ਕਰਦੇ ਹਾਂ